ਹਾਂ ਮੈਨੂੰ ਰਾਜਨੀਤੀ ਅਤੇ ਰਾਜ ਭਲਾਈ ਬਾਰੇ ਖਬਰਾਂ ਵਿੱਚ ਦਿਲਚਸਪੀ ਹੈ ਮੈਂ ਰਾਜਨੀਤੀ ਦੀ ਖਬਰਾਂ ਅਕਸਰ ਪੜ੍ਹਦਾ ਰਹਿੰਦਾ ਹਾਂ ਅੱਜ ਕੱਲ੍ਹ ਰਾਜਨੀਤੀ ਦਾ ਸਤਰ ਬਹੁਤ ਜ਼ਿਆਦਾ ਗਿਰ ਗਿਆ ਹੈ ਪੈਸੇ ਵਾਸਤੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਤਬਦੀਲ ਹੋ ਜਾਣਾ ਇੱਕ ਆਮ ਗੱਲ ਹੈ ਹਰ ਰਾਜਨੇਤਾ ਚੋਰ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਵਿੱਚ ਲੁਪਤ ਹੈ ਕਿਸੇ ਨੂੰ ਵੀ ਲੋਕ ਕਲਿਆਣ ਅਤੇ ਰਾਜ ਭਲਾਈ ਦੇ ਬਾਰੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਹਰ ਰਾਜਨੇਤਾ ਹਰ ਰਾਜਨੀਤਿਕ ਸਿਰਫ ਆਪਣੀ ਜੇਬ ਆਪਣੇ ਘਰ ਆਪਣੇ ਪੈਸੇ ਬਾਰੇ ਸੋਚਦਾ ਹੈ ਜਿਸ ਕਰਕੇ ਅਗਰ ਦੇਸ਼ ਦਾ ਨੁਕਸਾਨ ਵੀ ਹੋ ਜਾਵੇ ਤੋ ਉਸ ਨੂੰ ਉਹਦੇ ਨਾਲ ਕੋਈ ਦਿਲਚਸਪੀ ਨਹੀਂ ਹੈ ਮੌਜੂਦਾ ਸਰਕਾਰਾਂ ਵਿੱਚ ਕਿਸਾਨ ਅਧਿਆਪਕ ਸਟੂਡੈਂਟਸ ਸਾਰੇ ਹੀ ਪਰੇਸ਼ਾਨ ਨੇ ਕਿਸੇ ਨੂੰ ਰੋਜ਼ਗਾਰ ਨਹੀਂ ਕਿਸੇ ਨੂੰ ਸੁਚੱਜੀ ਪੜ੍ਹਾਈ ਨਹੀਂ ਕਿਸੇ ਨੂੰ ਨੌਕਰੀਆਂ ਨਹੀਂ ਸਾਰੇ ਆਪਣੇ ਪਰਿਵਾਰ ਵਿੱਚ ਦੁਖੀ ਹਨ ਮੌਜੂਦਾ ਸਰਕਾਰ ਸਿਰਫ ਨਸ਼ੇ ਹਥਿਆਰਬੰਦ ਲੋਕ ਅਤੇ ਪੈਸੇ ਦੀ ਵਰਤੋਂ ਨਾਲ ਮਾਹੌਲ ਨੂੰ ਖਰਾਬ ਕਰਨ ਵਾਸਤੇ ਕਾਰ ਬਾਜ਼ਾਰ ਉੱਤੇ ਪ੍ਰਸਸਤ ਹੈ ਕੋਈ ਵੀ ਰਾਜਨੇਤਾ ਕੋਈ ਵੀ ਆਪਣੇ ਸਟੇਟ ਆਪਣੇ ਦੇਸ਼ ਬਾਰੇ ਨਹੀਂ ਸੋਚਦਾ ਸਿਰਫ ਆਪਣੇ ਪੈਸੇ ਆਪਣੇ ਬਾਰੇ ਔਰ ਆਪਣੀ ਪਾਰਟੀ ਦੇ ਬਾਰੇ ਸੋਚਦਾ ਹੈ